ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਫ਼ਲ ਦੇ ਪੌਦੇ ਲਗਾਉਣਾ ਪਸੰਦ ਕਰਾਂਗੇ ਸਾਡੇ ਘਰਾਂ ਦੇ ਵਿੱਚ ਜਾਂ ਵਿਹੜੇ ਦੇ ਵਿੱਚ ਫ਼ਲਾਂ ਨੂੰ ਕੁਝ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਕਿਉਂਕਿ ਫ਼ਲ ਬਾਜ਼ਾਰਾਂ ਦੇ ਵਿੱਚ ਕਈ ਤਰ੍ਹਾਂ ਦੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਜਿਸ ਕਰਕੇ ਮਨੁੱਖ ਦੀ ਜਿਹੜੀ ਹ ਅ ਹਾਲਤ ਹੈਗੀ ਉਹ ਦਿਨੋ ਦਿਨ ਕੀ ਆ ਵਿਗੜਦੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਅਸੀਂ ਆਪਣੇ ਆਲੇ ਦੁਆਲੇ ਅਤੇ ਆਪਣੇ ਘਰਾਂ ਦੇ ਵਿੱਚ ਫ਼ਲਾਂ ਦੀ ਵਰਤੋਂ ਕਰਾਂਗੇ ਤਾਂ ਅਸੀਂ ਕੋਈ ਵੀ ਨਸ਼ੀਲੀ ਪਦਾਰਥ ਦੀ ਵਰਤੋਂ ਨਹੀਂ ਕਰਾਂਗੇ ਅਤੇ ਆਪਣੇ ਘਰਾਂ ਦੇ ਵਿੱਚ ਨੈਚੁਰਲੀ ਤਰੀਕੇ ਨਾਲ ਕੀ ਆ ਫ਼ਲਾਂ ਦਾ ਯੂਜ਼ ਕਰਕੇ ਇਹਨਾਂ ਦੀ ਵਰਤੋਂ ਕਰਾਂਗੇ ਅਤੇ ਸਰੀਰ ਨੂੰ ਸਿਹਤਮੰਦ ਬਣਾਵਾਂਗੇ ਫ਼ਲ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹਨ ਫ਼ਲਾਂ ਦੇ ਨਾਲ ਸਾਡੇ ਵਿਟਾਮਨਾਂ ਦੇ ਵਿੱਚ ਵਿਟਾਮਨਾਂ ਦੀ ਜਿਹੜੀ ਕਮੀ ਹੁੰਦੀ ਆ ਉਹਨਾਂ ਨੂੰ ਦੂਰ ਕਰਦੇ ਹਨ ਅਤੇ ਫ਼ਲਾਂ ਦੇ ਦੁਆਰਾ ਹੀ ਪਾਚਨ ਪ੍ਰਣਾਲੀ ਅਤੇ ਮਿਊਨਿਟੀ ਸਿਸਟਮ ਨੂੰ ਵੀ ਸਟਰੋਂਗ ਹੁੰਦਾ ਹੈ ਅਤੇ ਮਸੰਮੀ ਮਸੰਮੀ ਨਿੰਬੂ ਅਨਾਰ ਤਰਬੂਜ ਅਮਰੂਦ ਇਹ ਸਾਰੇ ਫ਼ਲ ਮਨੁੱਖ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ ਜਿਵੇਂ ਤਰਬੂਜ ਹੈ ਤਰਬੂਜ ਸਾਡੇ ਸਿਹਤ ਲਈ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਅਮਰੂਦ ਦੇ ਵਿੱਚ ਬਹੁਤ ਸਾਰੇ ਤੱਤ ਵਿਟਾਮਨਾਂ ਦੀਆਂ ਕਮੀਆਂ ਨੂੰ ਦੂਰ ਕਰਦਾ ਹੈ ਜਿਵੇਂ ਜਾਮਣ ਦਾ ਦਰਖਤ ਜਾਮਣ ਦਾ ਪੌਦਾ ਹੈ ਜਾਮਣ ਦੇ ਪੌਦੇ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਬਹੁਤ ਲਾਹੇਵੰਦ ਹੈ ਅਤੇ ਬਹੁਤ ਵਧੀਆ ਸਹਾਇਤਾ ਮਿਲਦੀ ਹੈ ਅਤੇ ਇਸ ਪ੍ਰਕਾਰ ਅ ਜਿਹੜੇ ਫ਼ਲਾਂ ਦੇ ਪੌਦੇ ਹੈਗੇ ਉਹ ਮਨੁੱਖ ਦੀ ਭਲਾਈ ਲਈ ਬਹੁਤ ਜ਼ਰੂਰੀ ਹਨ ਅਤੇ ਬਾਜ਼ਾਰਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਿਸ ਕਰਕੇ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਸਮਾਜ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪਣੇ ਪਿੰਡ ਆਪਣੇ ਸ਼ਹਿਰ ਆਪਣੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਫ਼ਲ ਲਗਾਓ ਜਿਸ ਨਾਲ ਮਨੁੱਖ ਆਪਣੀ ਸਿਹਤ ਵੱਲ ਵੀ ਸਿਹਤ ਵੱਲ ਵੀ ਆਪਾਂ ਬੱ ਬੱਚਿਆਂ ਨੂੰ ਅਤੇ ਸਮਾਜ ਨੂੰ ਸਾਰਿਆਂ ਨੂੰ ਜਾਗਰੂਕ ਕਰ ਸਕੀਏ ਜਿਸ ਨਾਲ ਸਮਾਜ ਦੇ ਵਿੱਚ ਹੈਲਪ ਹੋ ਸਕੇ ਅਤੇ ਸਾ ਇਨਵਾਇਰਮੈਂਟ ਇਨਵਾਇਰਮੈਂਟ ਵੀ ਹੈ ਕੀ ਹੈ ਫ਼ਲਾਂ ਦੇ ਨਾਲ ਕੀ ਹੈ ਸਾਫ਼ ਸੁਥਰਾ ਰਹਿੰਦਾ ਹੈ ਅਤੇ ਅ ਫ਼ਲਾਂ ਦੇ ਦੁਆਰਾ ਹੀ ਮਨੁੱਖ ਨੂੰ ਅਤੇ ਜੀਵ ਜੰਤੂਆਂ ਨੂੰ ਸਾਰਿਆਂ ਨੂੰ ਹੀ ਮਦਦ ਮਿਲਦੀ ਹੈ ਅਤੇ ਇਸ ਤਰ੍ਹਾਂ ਫ਼ਲ ਸਾਡੀ ਸਿਹਤ ਅਤੇ ਜੀਵ ਜੰਤੂਆਂ ਦੇ ਲਈ ਬਹੁਤ ਜ਼ਰੂਰੀ ਹਨ